ਦੋੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਦੌੜਨ ਨਾਲ ਮਾਨਸਿਕ ਸਿਹਤ ਅਤੇ ਤੰਦਰੁਸਤੀ 'ਤੇ ਸਕਾਰਾਤਮਕ ਪ੍ਰਭਾਵ ਪੈਂਦੇ ਹਨ ਦੌੜਨ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਹਾਂ ਦੌੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਦੌੜਦੇ ਹਾਂ ਤਾਂ ਆਪਣਾ ਜਿਹੜਾ ਅਨ ਸਰਕਲ ਹੁੰਦਾ ਗਾ ਬਲੱਡ ਸਰਕੂਲੇਟ ਉਹ ਵਧੀਆ ਚੱਲਦਾ ਹੈ ਅਤੇ ਆਪਣੇ ਸਰੀਰ ਦੇ ਅੰਦਰੂਨੀ ਅੰਗ ਸਾਰੇ ਆਪਣੀ ਚੰਗੀ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ ਸਿਰਫ਼ ਖਾਣਾ ਖਾ ਕੇ ਸੋਣਾ ਬੈਠਣ ਨਾਲ ਆਪਣੇ ਅੰਦਰੂਨੀ ਅੰਗ ਵੀ ਸੁਸਤ ਹੋ ਜਾਂਦੇ ਹਨ ਆਪਾਂ ਬੱਚਿਆਂ 'ਤੇ ਵੀ ਮੋਟਾਪਾ ਚਰਬੀ ਆ ਜਾਂਦੀ ਹੈ ਜਦੋਂ ਆਪਾਂ ਦੌੜਦੇ ਹਾਂ ਤਾਂ ਆਪਾਂ ਨੂੰ ਪਸੀਨਾ ਵੀ ਆਉਂਦਾ ਹੈ ਅਤੇ ਦੌੜਨ ਨਾਲ ਪਸੀਨੇ ਕਰਕੇ ਜੋ ਮੋਟਾਪਾ ਹੁੰਦਾ ਹੈ ਉਹ ਘੱਟ ਜਾਂਦਾ ਹੈ ਅਤੇ ਜਿਸ ਕਰਕੇ ਬੱਚਾ ਸਿਹਤਮੰਦ ਵੀ ਰਹਿੰਦਾ ਹੈ ਇਸ ਲਈ ਆਪਾਂ ਨੂੰ ਦੌੜਨਾ ਜ਼ਰੂਰੀ ਹੈ ਸੁਬਹਾ ਸੁਬਹਾ ਸਭਰ ਸੁਬਹਾ ਦੀ ਸੈਰ ਕਹਿੰਦੇ ਹਨ ਕਿ ਬਹੁਤ ਜ਼ਰੂਰੀ ਹੈ ਜਿਨ੍ਹਾਂ ਬਜ਼ੁਰਗਾਂ ਤੋਂ ਨਹੀਂ ਦੋੜਿਆ ਜਾਂਦਾ ਉਹਨਾਂ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਹਲਕਾ ਤੋਰਾ ਫੇਰਾ ਕਰਨਾ ਚਾਹੀਦਾ ਆਪਣੇ ਘਰ ਦੇ ਨੇੜੇਲੇ ਕਿਸੇ ਪਾਰਕ ਮੰਡੀ ਜਾਂ ਕਿਸੇ ਵੀ ਖੁੱਲ੍ਹੀ ਜਗ੍ਹਾ 'ਤੇ ਜਾਣਾ ਚਾਹੀਦਾ ਹੈ ਐਕਸਰਸਾਇਜਾਂ ਕਰਨੀਆ ਚਾਹੀਦੀਆਂ ਹਨ ਕਸਰਤਾਂ ਕਰਨ ਨਾਲ ਵੀ ਆਪਣਾ ਸਰੀਰ ਵਿੱਚ ਸਾ ਸਾਰੇ ਅੰਗ ਆਪਣੀ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਹਨ ਅਤੇ ਇਹ ਆਪਣਾ ਆਪ ਨੂੰ ਸਵਸਥ ਰੱਖਦੇ ਹਨ ਜਦੋਂ ਆਪਾਂ ਸੁਬਹਾ ਸੁਬਹਾ ਦੀ ਸੈਰ ਕਰਕੇ ਆਉਂਦੇ ਹਾਂ ਤਾਂ ਆਪਣੇ ਆਪ ਨੂੰ ਆਪਾਂ ਇੱਕ ਫੁਰਤੀਲਾ ਮਹਿਸੂਸ ਕਰਦੇ ਹਾਂ ਨਹੀਂ ਤਾਂ ਸਾਰਾ ਦਿਨ ਅਪਾ ਸੁਸਤ ਫੀਲ ਕਰਦੇ ਹਾਂ ਤੁਸੀਂ ਇਹ ਹੀ ਲਾ ਲਿਓ ਇੱਕ ਜਿਹੜਾ ਖਿਡਾਰੀ ਬੱਚਾ ਅਤੇ ਇੱਕ ਨੋਨ ਖਿਡਾਰੀ ਬੱਚਾ ਉਹਦੇ ਵਿੱਚ ਹੀ ਕੀ ਡਿਫਰੈਂਸ ਹੁੰਦਾ ਹੈ ਇੱਕ ਖਿਡਾਰੀ ਬੱਚਾ ਹਮੇਸ਼ਾ ਫੁਰਤੀਲਾ ਚੁਸਤ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਬੱਚਾ ਹੁੰਦਾ ਹੈ ਉਹ ਹਮੇਸ਼ਾ ਸੁਸਤੀ ਨਾਲ ਭਰਿਆ ਰਹਿੰਦਾ ਹੈ ਜਿਵੇ ਸਕੂਲ ਜਾ ਕੇ ਦੇਖਦੇ ਹੀ ਹਾਂ ਆਪਾਂ ਸੁਬਹਾ ਸੁਬਹਾ ਪਹਿਲਾਂ ਜਦੋਂ ਕਲਾਸਾਂ ਸ਼ੁਰੂ ਹੁੰਦੀਆਂ ਹਨ ਕਾਫੀ ਬੱਚੇ ਤਾਂ ਉਸ ਟਾਈਮ ਹੀ ਉਬਾਸੀਆਂ ਲੈ ਰਹੇ ਹੁੰਦੇ ਆ ਕਈਆਂ ਨੂੰ ਤਾਂ ਉਸ ਟਾਇਮ ਹੀ ਵੀ ਨੀਂਦ ਆ ਰਹੀ ਹੁੰਦੀ ਹੈ ਉਹਨਾਂ ਦੀ ਨੀਂਦ ਹੀ ਨਹੀਂ ਪੂਰੀ ਹੁੰਦੀ ਇਸ ਲਈ ਆਪਾਂ ਕਹਿੰਦੇ ਹਾਂ ਕਿ ਖੁਦ ਵੀ ਅੱਜ ਕੱਲ੍ਹ ਦੇ ਨੌਜਵਾਨਾਂ ਬਜ਼ੁਰਗਾਂ ਨੂੰ ਸੁਬਹਾ ਸੁਬਹਾ ਦੌੜ ਲਗਾਉਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਉਸ ਨਾਲ ਆਪਣਾ ਸਾਰਾ ਦਿਨ ਦਿਮਾਗ ਤਾਜ਼ਗੀ ਮਹਿਸੂਸ ਕਰਦਾ ਹੈ ਅਤੇ ਹਮੇਸ਼ਾ ਤਾਜ਼ਗੀ ਭਰਿਆ ਰਹਿੰਦਾ ਹੈ ਜਿਸ ਨਾਲ ਆਪਣੇ ਅੰਦਰ ਪੋਜੀਟਿਵ ਖਿਆਲ ਵੀ ਆਉਂਦੇ ਹਨ ਇਸ ਲਈ ਦੌੜ ਸਾਡੇ ਲਈ ਬਹੁਤ ਜ਼ਰੂਰੀ ਹੈ ਆਪਣਾ ਦੌੜਨਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਕੀ ਆ ਆਪਣੇ ਸਰੀਰ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਦੌੜ ਤੋਂ ਬਾਅਦ ਆਪਾਂ ਥੋੜ੍ਹਾ ਥੱਕ ਵੀ ਜਾਂਦੇ ਹਾਂ ਥੱਕਣ ਤੋਂ ਬਾਅਦ ਜਦੋਂ ਆਪਾਂ ਰਿਲੈਕਸ ਕਰਦੇ ਹਾਂ ਆਰਾਮ ਕਰਦੇ ਹਾਂ ਤਾਂ ਆਪਣੇ ਜਿਹੜੀ ਤਾਕਤ ਜੋ ਕਿ ਐਨਰਜੀ ਬੇਸਟ ਹੋਈ ਆ ਉਹ ਦੁਬਾਰਾ ਫਿਰ ਰਿਕਵਰ ਹੋ ਜਾਂਦੀ ਹੈ ਦੌੜਨ ਨਾਲ ਆਪਾਂ ਨਾ ਸਾਰੇ ਕੰਮ ਆਰਗਨ ਵਧੀਆ ਕੰਮ ਕਰਦੇ ਹਨ ਅਤੇ ਆਪਣਾ ਵੀ ਹਰ ਕੰਮ ਵਿੱਚ ਮਨ ਲੱਗਿਆ ਰਹਿੰਦਾ ਹੈ ਧੰਨਵਾਦ